ਸਤਿ ਸ਼੍ਰੀ ਅਕਾਲ ਸਰ ਹੋਰ ਕੀ ਹਾਲ ਚਾਲ ਹੈ ਜਿਵੇਂ ਕਿ ਮੈਂ ਤੁਹਾਡੀ ਦੁਕਾਨ ਤੋਂ ਜਿਵੇਂ ਕਿ ਤੁਹਾਡੀ ਦੁਕਾਨ ਦਾ ਨਾਮ ਮੋਹਿਤ ਲੈਪਟੋਪ ਇੰਟਰਪ੍ਰਾਈਸਸ ਹੈ ਅਤੇ ਮੈਂ ਉੱਥੋਂ ਲੈਪਟੋਪ ਲੈ ਕੇ ਗਈ ਲੈਪਟੋਪ ਔਡਰ ਕੀਤਾ ਸੀ ਅਤੇ ਉਸ ਲੈਪਟੋਪ ਦੀ ਡਿਲੀਵਰੀ ਪਹਿਲਾਂ ਤੁਸੀਂ ਲੈਪਟੋਪ ਦੀ ਡਿਲੀਵਰੀ ਹੀ ਮੈਨੂੰ ਬਹੁਤ ਹੀ ਜ਼ਿਆਦਾ ਲੇਟ ਮਿਲੀ ਹੈ ਜਿਵੇਂ ਕਿ ਤੁਹਾਡੇ ਨਾਲ ਗੱਲ ਹੋਈ ਸੀ ਤੁਸੀਂ ਕਿਹਾ ਸੀ ਕਿ ਲੈਪਟੋਪ ਦੋ ਦਿਨ ਦੇ ਅੰਦਰ ਅੰਦਰ ਤੁਹਾਡੇ ਘਰ ਪਹੁੰਚ ਜਾਵੇਗਾ ਪਰ ਉਸਦੀ ਡਿਲੀਵਰੀ ਲਗਭਗ ਪੰਜ ਦਿਨ ਬਾਅਦ ਹੋਈ ਹੈ ਅਤੇ ਉਸ ਦੀ ਡਿਲੀਵਰੀ ਲੇਟ ਕਾਰਨ ਮੈਂ ਪਹਿਲਾਂ ਹੀ ਬਹੁਤ ਨਾ ਖੁਸ਼ ਸੀ ਅਤੇ ਜਦੋਂ ਮੈਂ ਉਸਦੀ ਡਿਲੀਵਰੀ ਲੈਣ ਲਈ ਜੋ ਡਿਲੀਵਲੀ ਡਿਲੀਵਰੀ ਕਰਨ ਆਇਆ ਹੋਇਆ ਸੀ ਉਸ ਕੋਲ ਗਈ ਤਾਂ ਉਸਨੇ ਵੀ ਉਸ ਵਿਵਹਾਰ ਕੁਛ ਚੰਗਾ ਨਹੀਂ ਕੀਤਾ ਉਹ ਬਹੁਤ ਹੀ ਬੁਰੇ ਤਰੀਕੇ ਨਾਲ ਥੋੜ੍ਹਾ ਖਿੱਝ ਕੇ ਉਸਨੇ ਬੋਲਿਆ ਮੈਨੂੰ ਜਦ ਮੈਂ ਉਹਨੂੰ ਪੁੱਛਿਆ ਕਿ ਡਿਲੀਵਰੀ ਐਨੀ ਲੇਟ ਕਿਉਂ ਹੈ ਤਾਂ ਉਸ ਨੇ ਖਿੱਝ ਕੇ ਮੈਨੂੰ ਜਵਾਬ ਦਿੱਤਾ ਕਿ ਇਸ ਬਾਰੇ ਮੇਰੇ ਨਾਲ ਕੋਈ ਗੱਲ ਨਾ ਕੀਤੀ ਜਾਵੇ ਇਸ ਬਾਰੇ ਗੱਲ ਜੋ ਹੈ ਉਹ ਜੋ ਦੁਕਾਨ ਵਾਲੇ ਆ ਉਹਨਾਂ ਨਾਲ ਕੀਤੀ ਜਾਵੇ ਇਸ ਵਿੱਚ ਮੇਰੀ ਕੋਈ ਗਲਤੀ ਨਹੀਂ ਹੈ ਅਤੇ ਮੈਂ ਇਸ ਤੋਂ ਵੀ ਬਹੁਤ ਹੀ ਨਾ ਖੁਸ਼ ਹੋਈ ਕਿ ਮੈਨੂੰ ਇਸ ਤਰ੍ਹਾਂ ਦਾ ਜਵਾਬ ਦਿੱਤਾ ਗਿਆ ਮੈਂ ਸਿਰਫ ਉਸ ਤੋਂ ਇੱਕ ਸਾਧਾਰਨ ਪ੍ਰਸ਼ਨ ਹੀ ਪੁੱਛਿਆ ਸੀ ਕਿ ਇਸ ਮੇਰੇ ਲੈਪਟੋਪ ਦੀ ਡਿਲੀਵਰੀ ਲੇਟ ਕਿਉਂ ਹੋਈ ਜਦੋਂ ਮੈਂ ਲੈਪਟਰੋਪ ਲੈਪਟੋਪ ਆਪਣੇ ਘਰ ਲੈ ਕੇ ਆਈ ਜਦੋਂ ਮੈਂ ਉਸਦੀ ਪੈਕਿੰਗ ਦੇਖੀ ਸਭ ਤੋਂ ਪਹਿਲਾਂ ਤਾਂ ਉਸਦੀ ਪੈਕਿੰਗ ਬਹੁਤ ਹੀ ਨਾ ਖੁਸ਼ ਸੀ ਮਤਲਬ ਕਿ ਮੈਂ ਉਸਦੀ ਪੈਕਿੰਗ ਤੋਂ ਬਹੁਤ ਹੀ ਨਾ ਖੁਸ਼ ਸੀ ਮੈਨੂੰ ਉਸਦੀ ਪੈਕਿੰਗ ਬਿਲਕੁਲ ਵੀ ਪਸੰਦ ਨਹੀਂ ਆਈ ਅਤੇ ਜਿਸ ਮੈਂ ਉਸਨੂੰ ਖੋਲ੍ਹਿਆ ਉਸ ਦੀ ਪੈਕਿੰਗ ਨੂੰ ਖੋਲ੍ਹਿਆ ਸਭ ਤੋਂ ਪਹਿਲਾਂ ਤਾਂ ਉਸ ਵਿੱਚ ਉਸਦਾ ਚਾਰਜਰ ਨਹੀਂ ਸੀ ਅਤੇ ਚਾਰਜਰ ਮਿਸਪਲੇਸ ਹੋਣ ਕਰਕੇ ਵੀ ਮੈਂ ਤੁਹਾਨੂੰ ਇਸਦਾ ਕਹਿਣਾ ਚਾਹੁੰਦੀ ਕਿ ਉਸ ਵਿੱਚ ਚਾਰਜਰ ਨਹੀਂ ਹੈ ਜਦਕਿ ਚਾਰਜਰ ਤਾਂ ਹਰ ਲੈਪਟੋਪ ਨਾਲ ਆਉਂਦਾ ਹੀ ਹੈ ਅਤੇ ਉਸਦਾ ਚਾਰਜਰ ਹੀ ਨਹੀਂ ਹੈ ਉਸ ਵਿੱਚ ਅਤੇ ਜਦ ਮੈਂ ਉਸਨੂੰ ਔਨ ਕੀਤਾ ਜਦਕਿ ਮੈਂ ਆਈ ਸੈਵਨ ਜਨਰੇਸ਼ਨ ਦਾ ਲੈਪਟੋਪ ਤੁਹਾਨੂੰ ਔਡਰ 'ਤੇ ਦਿੱਤਾ ਹੋਇਆ ਸੀ ਕਿ ਮੈਨੂੰ ਆਈ ਸੈਵਨ ਜਨਰੇਸ਼ਨ ਦਾ ਲੈਪਟੋਪ ਚਾਹੀਦਾ ਹੈ ਅਤੇ ਜਦੋਂ ਔਡਰ ਦੇਖਿਆ ਤਾਂ ਮੈਂ ਔਡਰ ਵਿੱਚ ਆਈ ਫਾਈਵ ਜਨਰੇਸ਼ਨ ਸੀ ਜਦਕਿ ਮੈਂ ਤੁਹਾਨੂੰ ਜੋ ਉਸਦੇ ਲੈਪਟੋਪ ਦਾ ਜੋ ਭੁਗਤਾਨ ਹੈ ਜੋ ਉਸਦੀ ਪੇਮੈਂਟ ਹੈ ਤੁਹਾਨੂੰ ਆਈ ਸੈਵਨ ਜਨਰੇਸ਼ਨ ਲੈਪਟੋਪ ਦੀ ਕੀਤੀ ਹੋਈ ਹੈ ਤਾਂ